ਪੁਰਾਣੇ ਅਤੇ ਹੁਣ ਦੇ ਫੋਨ ਵਿੱਚ ਕਾਫੀ ਅੰਤਰ ਆ ਗਿਆ ਪਹਿਲਾ ਫੋਨ ਬਟਨ ਵਾਲੇ ਹੁੰਦੇ ਸਨ ਉਹਨਾਂ ਦੀ ਸਕਰੀਨ ਛੋਟੀ ਹੁੰਦੀ ਸੀ ਅਤੇ ਬੈਟਰੀ ਬਹੁਤ ਲੰਬਾ ਚਲਦੀ ਸੀ ਉਹ ਸਿਰਫ ਕਾਲ ਕਰਨ ਅਤੇ ਐਸ ਐਮ ਐਸ ਭੇਜਣ ਲਈ ਵਰਤੇ ਜਾਂਦੇ ਸਨ ਦੂਜੇ ਪਾਸੇ ਅੱਜਕੱਲ ਦੇ ਸਮਾਰਟ ਫੋਨ ਪੂਰੀ ਤਰ੍ਹਾਂ ਟੱਚ ਸਕਰੀਨ ਵਾਲੇ ਪਤਲੇ ਅਤੇ ਆਧੁਨਿਕ ਡਿਜਾਇਨ ਵਾਲੇ ਹਨ ਕੁਛ ਫੋਨਾਂ ਵਿੱਚ ਹਾਈ ਕੁਆਲਿਟੀ ਕੈਮਰਾ ਇੰਟਰਨੈਟ ਐਪਲੀਕੇਸ਼ਨ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਫਾਈਵ ਜੀ ਤਕਨੀਕ ਵਰਗੀਆਂ ਸੁਵਿਧਾਵਾਂ ਹੁੰਦੀਆਂ ਸਨ ਪਹਿਲਾਂ ਜਿੱਥੇ ਸਿਰਫ ਸੰਪਰਕ ਬਣਾਉਣ ਲਈ ਫੋਨ ਵਰਤੇ ਜਾਂਦੇ ਸਨ ਹੁਣ ਉਹ ਦਫਤਰੀ ਕੰਮ ਮਨੋਰੰਜਨ ਸਿੱਖਿਆ ਅਤੇ ਸੋਸ਼ਲ ਮੀਡੀਆ ਵਰਤਨ ਲਈ ਇੱਕ ਮੁੱਖ ਸਾਧਨ ਬਣ ਗਏ ਹਨ ਪੁਰਾਣੇ ਫੋਨ ਮੋਟੇ ਭਾਰੀ ਅਤੇ ਪਲਾਸਟਿਕ ਦੀ ਬਾਡੀ ਵਾਲੇ ਹੁੰਦੇ ਸਨ ਸਕਰੀਨ ਛੋਟੀ ਉਹਦੇ ਬਟਨ ਵਾਲੀ ਹੁੰਦੀ ਸੀ ਨਵੇਂ ਫੋਨ ਪਤਲੇ ਹਲਕੇ ਅਤੇ ਗਲਾਸ ਜਾਂ ਐਲਮੇਨੀਅਮ ਬਾਡੀ ਨਾਲ ਬਣੇ ਹੋਏ ਹੁੰਦੇ ਹਨ ਪੂਰੀ ਟੱਚ ਸਕਰੀਨ ਡਿਜ਼ਾਇਨ ਨਾਲ ਵੇਜਲੈਸ ਅਤੇ ਫੋਡਏਬਲ ਸਕਰੀਨ ਦੇ ਵਿਕਲਪ ਵੀ ਉਪਲੱਬਧ ਹਨ ਪੁਰਾਣੇ ਫੋਨ ਘੱਟ ਲੈਜੀਨੇਸ਼ਨ ਵਾਲੇ ਕੈਮਰਾ ਬਿਨਾਂ ਫਓਰਸ ਦਾ ਫਲੈਸ਼ ਤੇ ਤੇ ਨਵੇਂ ਫੋਨ ਹਾਈ ਕੁਆਲਟੀ ਕੈਮਰਾ ਮਲਟੀਪਲੈਸ ਲੈਸ ਸਿਸਟਮ ਨਾਈਟ ਮੋਡ ਅਤੇ ਚਿੱਤਰ ਸੁਧਾਰ ਉਤੇ ਅਧਾਰਿਤ ਪੁਰਾਣੇ ਫੋਨ ਸੀਮਤ ਪ੍ਰਦਰਸ਼ਨ ਬੁਨਿਆਦੀ ਗੇਮਾਂ ਅਤੇ ਐਪਲੀਕੇਸ਼ਨਾਂ ਲਈ ਨਵੇਂ ਫੋਨ ਹਾਈ ਪਰਫੋਰਮੈਂਸ ਪ੍ਰੋਫੈਸਰ ਵਾਧਰ ਰੈਡਮ ਐਕਸੈਸ ਮੈਮਰੀ ਅਤੇ ਗ੍ਰਾਫਿਕ ਲੇ ਵਿਸ਼ੇਸ਼ ਪ੍ਰੋਗਰਾਮਿੰਗ ਯੂਨਿਟ ਨਾਲ ਜੋ ਹਾਈ ਐਂਡ ਗੇਮਿੰਗ ਅਤੇ ਮਲਟੀਪਲੈਸ ਲਈ ਉਚਿਤ ਹਨ